ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਅਨਕੂਲਿਤ ਇਨਕੂਲਿਤ ਕਰਦੀ ਹੈ ਪੰਜਾਬ ਵਿੱਚ ਕਈ ਤਰ੍ਹਾਂ ਦੇ ਲੋਕ ਹਨ ਅੰਨੇ ਅਪਾਹਿਜ ਹੋਰ ਵੀ ਕਈ ਲੋਕ ਹਨ ਉਹ ਵੀ ਸਾਡੇ ਪੰਜਾਬ ਲਈ ਜ਼ਰੂਰੀ ਹਨ ਕਿਉਂਕਿ ਉਹ ਵੀ ਸਾਡੇ ਪੰਜਾਬ ਦਾ ਹਿੱਸਾ ਆ ਗਏ ਹਨ ਇਸ ਲਈ ਉਹਨਾਂ ਨੂੰ ਵੀ ਅੱਗੇ ਵੱਧ ਕੇ ਰੱਖਣਾ ਪੈਂਦਾ ਹੈ ਸਰਕਾਰ ਇਹ ਪੰਜਾਬ ਵਿੱਚ ਹੋਰ ਵੀ ਸਰਕਾਰਾਂ ਆਉਂਦੀਆਂ ਹਨ ਹੋਰ ਵੀ ਕਈ ਤਰ੍ਹਾਂ ਦੇ ਐਨ ਜੀ ਓ ਵਗੈਰਾ ਬਣੇ ਹੋਏ ਹਨ ਜੋ ਕਿ ਬਹੁਤ ਮਦਦ ਕਰਦੇ ਹਨ ਸਰਕਾਰ ਸਰ ਭਾਰਤ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ ਸਿੱਖਿਆ ਪ੍ਰਣਾਲੀ ਤਾਂ ਸਾਡੇ ਪੰਜਾਬ ਲਈ ਬਹੁਤ ਜ਼ਿਆਦਾ ਵਧੀਆ ਵਧੀਆ ਹੈਗੀ ਹੈ ਜੋ ਕਿ ਪੰਜਾਬ ਸਿੱਖਿਆ ਪ੍ਰਣਾਲੀ ਸਾਡੇ ਲਈ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਪੰਜਾਬ ਵਿੱਚ ਕਈ ਤਰ੍ਹਾਂ ਦੇ ਲੋਕ ਸਿੱਖਿਆ ਪ੍ਰਣਾਲੀ ਨੂੰ ਪ੍ਰਫੁੱਲਿਤ ਕਰਦੇ ਹਨ